ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਆਂ ਕੀ ਆਪ ਜੀ ਸੋਚਦੇ ਹੋ ਕਿ ਮੀਡੀਆ ਅਤੇ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਨੂੰ ਉਚਿਤ ਰੂਪ ਵਿੱਚ ਦਰਸਾਇਆ ਗਿਆ ਹੈ ਉਹ ਇਸ ਤਰ੍ਹਾਂ ਹੀ ਪੰਜਾਬੀ ਭਾਸ਼ਾ ਸਾਡੇ ਦੇਸ਼ ਦੀ ਹੀ ਮਾਂ ਬੋਲੀ ਹੈ ਮਾਂ ਬੋਲੀ ਹੈ ਮੈਂ ਚਾਹੁੰਦਾ ਹਾਂ ਕਿ ਜਿੱਦਾਂ ਮੀਡੀਆ ਵਿੱਚ ਮੀਡੀਆ ਵਿੱਚ ਲੋਕ ਆਪਣੀ ਇੰਟਰੋਡਕਸ਼ਨ ਇੰਗਲਿਸ਼ ਵਿੱਚ ਦਿੰਦੇ ਨੇ ਉਹ ਸਾਰੇ ਕਿ ਪੰਜਾਬੀ ਵਿੱਚ ਦੱਸਣ ਕਿ ਪੰਜਾਬੀ ਭਾਸ਼ਾ ਸਾਡੀ ਪੰਜਾਬ ਦੀ ਇੱਕ ਮੁੱਖ ਪਰਿਭਾਸ਼ਾ ਹੈ ਇਸ ਲਈ ਸਾਨੂੰ ਆਪਣੀ ਪੰਜਾਬੀ ਭਾਸ਼ਾ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਲੋਕ ਸੋਚਦੇ ਹਨ ਕਿ ਜਿਹੜਾ ਬੰਦਾ ਪੰਜਾਬੀ ਬੋਲਦਾ ਹੈ ਕਿ ਉਹ ਅਨਪੜ੍ਹ ਵਿੱਚ ਗਿਣਿਆ ਜਾਂਦਾ ਹੈ ਨਹੀਂ ਪੰਜਾਬੀ ਭਾਸ਼ਾ ਸਾਡੇ ਪੰਜਾਬ ਦੀ ਪ੍ਰਮੁੱਖ ਭਾਸ਼ਾ ਹੈ